ਸਾਰੇ ਜਾਣਦੇ ਹਾਂ ਕਿ ਪਾਣੀ ਸਾਡੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਹਿੱਸਾ ਹੈ ਆ ਜਿਵੇਂ ਆਪਾਂ ਗੁਰਬਾਣੀ ਵਿੱਚ ਵੀ ਲਿਖਿਆ ਹੈਗਾ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦੀ ਥਾਂ 'ਤੇ ਮਹੱਤਤਾ ਦਿੱਤੀ ਗਈ ਆ ਪਾਣੀ ਸਾਨੂੰ ਪੰਜਾਬ ਦੇ ਵਿੱਚ ਪਹਿਲਾਂ ਤਾਂ ਨਹੀਂ ਕਮੀ ਸੀ ਪਾਣੀ ਦੀ ਪਰ ਅੱਜ ਕੱਲ੍ਹ ਪਾਣੀ ਦੀ ਕਮੀ ਆ ਰਹੀ ਹੈ ਜਿਹੜਾ ਕਿ ਚਿੰਤਾ ਦਾ ਵਿਸ਼ਾ ਆ ਸੋ ਪੀਣ ਵਾਲਾ ਪਾਣੀ ਵੀ ਜਮੀਨੀ ਪੱਧਰ ਦੇ ਵਿੱਚ ਪ੍ਰਦੂਸ਼ਿਤ ਹੋ ਰਿਹਾ ਹੈ ਜਿਹਦੇ ਕਰਕੇ ਹੁਣ ਅੱਜ ਕੱਲ੍ਹ ਪਾਣੀ ਸਾਨੂੰ ਟੂਟੀਆਂ ਰਾਹੀਂ ਜਾਂ ਸਰਕਾਰੀ ਟੈਂਕੀਆਂ ਤੋਂ ਪਾਣੀ ਜਿਹੜਾ ਪ੍ਰਾਪਤ ਹੁੰਦਾ ਆ ਇਹ ਪਾਣੀ ਦਾ ਕੁਛ ਟਾਈਮ ਹੁੰਦਾ ਆ ਫਿਕਸ ਜਿਵੇਂ ਅਸੀਂ ਉਦੋਂ ਹੀ ਇਹਨੂੰ ਯੂਸ ਕਰ ਸਕਦੇ ਹਾਂ ਜਿਵੇਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਪਾਣੀ ਦੇ ਵਿੱਚ ਵੀ ਅਸੀਂ ਸ਼ਹਿਨਸ਼ਾਹ ਸੀਗੇ ਕਿ ਜਿਵੇਂ ਮਰਜ਼ੀ ਖੁੱਲ੍ਹਾ ਵਰਤੀਏ ਜਾਂ ਖੁੱਲ੍ਹਾ ਜੋ ਵੀ ਕਰੀਏ ਜਿੰਨਾ ਅਸੀਂ ਉਹ ਕਰਦੇ ਰਹੇ ਅਸੀਂ ਪਾਣੀ ਘਟਾ ਲਿਆ ਜਿਹੜਾ ਪਾਣੀ ਸਾਨੂੰ ਸਰਕਾਰੀ ਜਾਂ ਟੂਟੀਆਂ ਰਾਹੀ ਮਿਲਦਾ ਸਾਨੂੰ ਸਟੋਰ ਕਰਨਾ ਪੈਂਦਾ ਆ ਅਤੇ ਉਹਦੇ ਨਾਲ ਹੀ ਸਾਨੂੰ ਸਾਰਨਾ ਪੈਂਦਾ ਹੈ ਪਾਣੀ ਸਾਫ ਹੁੰਦਾ ਹੈ ਕਿਉਂਕਿ ਉਹਨੂੰ ਟਾਈਮਲੀ ਉਹਦੇ ਵਿੱਚ ਕਲੋਰੋਫਿਨ ਵਗੈਰਾ ਡਾਲ ਕੇ ਜਿਹੜੇ ਸਰਕਾਰੀ ਟੈਂਕੀਆਂ ਦੇ ਜਿੱਥੋਂ ਪਾਣੀ ਸਪਲਾਈ ਕੀਤਾ ਜਾਂਦਾ ਉਹਨਾਂ ਨੂੰ ਸਾਫ ਕਰਦੇ ਹਾਂ ਪਰ ਫਿਰ ਵੀ ਉਹ ਪਾਣੀ ਇੰਨਾ ਸਾਫ ਨਹੀਂ ਹੁੰਦਾ ਜਿਹੜਾ ਜਮੀਨ ਦੇ ਅੰਦਰੋਂ ਅਸੀਂ ਪਾਣੀ ਪ੍ਰਾਪਤ ਕਰਦੇ ਹਾਂ ਜਿੰਨਾ ਪਾਣੀ ਉਹ ਸਾਫ ਹੁੰਦਾ ਹੈ ਪਰ ਉਹ ਪਾਣੀ ਨੂੰ ਹੁਣ ਅਸੀਂ ਫਸਲਾਂ ਕੁਛ ਇਹੋ ਜਿਹੀਆਂ ਬੀਜਲੀਆਂ ਜਿਹੜੀਆਂ ਜ਼ਿਆਦਾ ਪਾਣੀ ਖਰਚ ਕਰਦੀਆਂ ਜਾਂ ਅਸੀਂ ਪਾਣੀ ਦੀ ਵਰਤੋਂ ਵੇਲੇ ਅਵੇਸਲੇ ਰਹਿੰਦੇ ਹਾਂ ਅਤੇ ਅਸੀਂ ਪਾਣੀ ਜਿਹੜਾ ਉਹ ਕਾਫੀ ਘੱਟ ਗਿਆ ਜਮੀਨੀ ਪੱਧਰ ਦੇ ਵਿੱਚ ਕਾਫੀ ਜਮੀਨ ਦੇ ਵਿੱਚ ਨੀਚਾ ਹੇਠਾਂ ਚਲੇ ਗਿਆ ਪਾਣੀ ਦਾ ਪੱਧਰ ਸੋ ਪਾਣੀ ਔਖਾ ਹੀ ਪ੍ਰਾਪਤ ਹੁੰਦਾ ਹੈ ਜਿਹੜਾ ਟੂਟੀਆਂ ਰਾਹੀ ਸਾਨੂੰ ਪਾਣੀ ਪ੍ਰਾਪਤ ਹੁੰਦਾ ਹੈ ਇੱਕ ਤਾਂ ਉਹ ਸਾਨੂੰ ਘੱਟ ਮਾਤਰਾ 'ਚ ਮਿਲਦਾ ਹੈ ਦੂਜਾ ਸਾਨੂੰ ਉਹਦੇ ਲਈ ਪੈਸੇ ਵੀ ਪੇ ਕਰਨੇ ਪੈਂਦੇ ਆ ਅਤੇ ਇਸ ਕਰਕੇ ਜਿਹੜਾ ਪਾਣੀ ਚਾਹੇ ਸਾਫ ਹੈ ਪਰ ਉਹ ਨਹੀਂ ਮਜ਼ਾ ਆ ਰਿਹਾ ਜਿਵੇਂ ਸ ਅਸੀਂ ਧਰਤੀ 'ਚੋਂ ਸਿੱਧਾ ਪਾਣੀ ਜਿਹੜਾ ਕੱਢ ਕੇ ਵਰਤਦੇ ਸੀ ਉਹ ਚੀਜ਼ ਨਹੀਂ ਸਾਨੂੰ ਮਿਲ ਰਹੀ